ਭੰਗੜੇ ਦੇ ਆਮ ਸਟੈਪ ਵਿੱਚ ਪੰਜਾਬ ਫੁਲਕਾ ਸੱਜੇ ਖੱਬੇ ਪੰਪ ਕਰਨ ਵਾਲਾ ਸਟੈਪ ਫਸਲਾਂ ਵਾਲਾ ਸਟੈਪ ਇਹ ਸਾਰੇ ਭੰਗੜੇ ਦੇ ਆਮ ਸਟੈਪ ਹਨ ਜੋ ਪੰਜਾਬੀ ਸੱਭਿਆਚਾਰ ਦਾ ਮੁੱਢਲਾ ਲੋਕ ਨਾਚ ਹੈ ਭੰਗੜਾ ਇਹ ਇੱਕ ਜੋਰ ਦਾਰ ਅਤੇ ਜਸ਼ਨ ਵਾਲੇ ਸੁਭਾਅ ਦਾ ਇੱਕ ਨਾਚ ਐ ਜੋ ਸਾਰਿਆਂ ਦਾ ਮਨ ਮੋਹ ਲੈਂਦਾ ਹੈ ਜਦੋਂ ਵੀ ਢੋਲ ਦਾ ਡਗਾ ਵੱਜਦਾ ਹੈ ਤਾਂ ਸਾਰੇ ਇੱਕ ਤਾਲ ਹੋ ਕੇ ਭੰਗੜਾ ਪਾਉਣ ਲੱਗ ਜਾਂਦੇ ਹਨ ਇੱਥੇ ਸਾਰੇ ਪੰਜਾਬੀ ਭਾਈਚਾਰਾ ਪੰਜਾਬ ਦੇ ਲੋਕ ਨਾਚ ਵਿੱਚ ਦਿਸਦਾ ਹੈ ਸਾਰੇ ਰਿਸ਼ਤੇਦਾਰ ਸੱਕੇ ਸੰਬੰਧੀ ਵਿਆਵਾਂ ਸ਼ਾਦੀਆਂ ਤੇ ਮੇਲੇ ਤਿਉਹਾਰਾਂ ਤੇ ਰਲ ਮਿਲ ਕੇ ਭੰਗੜਾ ਪਾਉਂਦੇ ਹਨ ਫਸਲਾਂ ਪੱਕਣ ਦੀ ਖੁਸ਼ੀ ਵਿੱਚ ਭੰਗੜੇ ਪਾਏ ਜਾਂਦੇ ਹਨ ਜੋ ਪੰਜਾਬੀ ਸੱਭਿਆਚਾਰ ਦਾ ਮੁੱਢਲਾ ਅੰਗ ਐ ਤੇ ਭੰਗੜਾ ਪੂਰਾ ਜੋਸ਼ ਨਾਲ ਭਰਪੂਰ ਇੱਕ ਨਾਚ ਐ ਜਿਸ ਨੂੰ ਵੇਖ ਕੇ ਨਾਲ ਮੱਲੋ ਮੱਲੀ ਸਾਰਿਆਂ ਦੇ ਪੈਰ ਨੱਚਣ ਨੂੰ ਕਾਲੇ ਪੈ ਜਾਂਦੇ ਹਨ ਸਾਰਿਆਂ ਦੇ ਮਨ ਵਿੱਚ ਇੰਨਾ ਚਾਹ ਤੇ ਇਨੀ ਖੁਸ਼ੀ ਹੁੰਦੀ ਹੈ ਉਹਨਂ ਦੇ ਚਿਹਰੇ ਉੱਤੇ ਰੋਮ ਰੋਮ ਉਹਨਾਂ ਦਾ ਨੱਚ ਉੱਠਦਾ ਭੰਗੜਾ ਸਾਰਿਆਂ ਦਾ ਦਿਲਚਸਪ ਨਾਚ ਐ ਪੰਜਾਬੀਆਂ ਦਾ ਭੰਗੜੇ ਨੂੰ ਵਿਆਵਾਂ ਸ਼ਾਦੀਆਂ ਮੇਲੇ ਤਿਉਹਾਰਾਂ ਤੇ ਸਾਰੇ ਰਲ ਮਿਲ ਕੇ ਚਾਹੇ ਕੋਈ ਸਕਾ ਹੋਵੇ ਭਾਵੇਂ ਨਾ ਹੋਵੇ ਮਿਲ ਕੇ ਪਾਉਂਦੇ ਹਨ ਭੰਗੜਾ ਬਹੁਤ ਵਧੀਆ ਨਾਚ ਹੈ